ਪਾਣੀ ਨੂੰ ਫਿਲਟਰ ਕਰਨ ਅਤੇ ਸ਼ੁੱਧ ਕਰਨ ਲਈ ਕੁਝ ਆਮ ਅਭਿਆਸ ਹਨ ਜੋ ਸਿ ਸਿਹਤਮੰਦ ਪ੍ਰਾਣੀ ਪ੍ਰਾਪਤ ਕਰਨ ਵਿੱਚ ਮਦਦ ਕਰਦੇ ਹਨ ਸਭ ਤੋਂ ਪਹਿਲਾਂ ਪਾਣੀ ਨੂੰ ਉਬਾਲਣਾ ਇੱਕ ਆਮ ਅਤੇ ਪ੍ਰਭਾਵਸ਼ਾਲੀ ਤਰੀਕਾ ਹੈ ਜਿਸ ਨਾਲ ਬੈਕਟੀਰੀਆ ਵਾਇਰਸ ਅਤੇ ਹੋਰ ਰੋਗਾਣੂ ਮਰ ਮਰੇ ਜਾਂਦੇ ਹਨ ਚਾਰਕੋਲ ਫਿਲਟਰ ਵੀ ਵਰਤੋਂ ਵਰਤੋਂ ਨਾਲ ਵੀ ਪਾਣੀ ਨੂੰ ਸੁਧਾਰਿਆ ਜਾ ਸਕਦਾ ਹੈ ਕਿਉਂਕਿ ਇਹ ਗੰਦੇ ਪਦਾਰਥ ਅਤੇ ਬੈਕਟੀਰੀਆ ਨੂੰ ਖਿੱਚ ਲੈਂਦੇ ਹਨ ਹੋਰ ਇੱਕ ਤਰੀਕਾ ਹੈ ਹੈਗਾ ਆਹ ਫਿਲਟਰ ਹੈ ਜੋ ਕਿ ਪਾਣੀ ਵਿੱਚ ਮੌਜੂਦ ਕਿਣੇ ਕਿਣੇ ਖਤਰਨਾਕ ਪਦਾਰਥਾਂ ਨੂੰ ਹਟਾਉਣ ਦਾ ਹੈ ਚਿੜੀ ਅਤੇ ਪੰਗਾ ਨਾਲ ਪਾਣੀ ਨੂੰ ਸੁਧਾਰਨ ਜਾਂਦਾ ਹੈ ਇਸ ਤੋਂ ਇਲਾਵਾ ਬਾਜ਼ਾਰ ਵਿੱਚ ਉਪਲਬਧ ਕਰਵਾਏ ਗਏ ਪਾਣੀ ਫਿਲਟਰ ਨੂੰ ਵੀ ਵਰਤਿਆ ਜਾ ਸਕਦਾ ਹੈ ਉਹ ਫਿਲਟਰ ਬਹੁਤ ਜ਼ਿਆਦਾ ਹੀ ਇੱਕ ਵਧੀਆ ਤਰੀਕੇ ਨਾਲ ਪਾਣੀ ਨੂੰ ਸਾਫ ਕਰ ਦਿੰਦੇ ਹਨ ਪਰ ਉਸ ਨੂੰ ਟਾਇ ਵਕਤ ਤੋਂ ਵਕਤ ਬਦਲਣਾ ਪੈਂਦਾ ਹੈ ਜਲ ਜਲ ਨੂੰ ਤੁਰੰਤ ਅਤੇ ਸ਼ੁੱਧ ਬਣਾਉਂਦਾ ਹੈ ਉਹ ਫਿਲਟਰ ਇਸ ਇਹ ਸਾਰੇ ਤਰੀਕੇ ਘਰੇਲੂ ਤੌਰ 'ਤੇ ਪਾਣੀ ਨੂੰ ਸ਼ੁੱਧ ਕਰਨ ਲਈ ਬਹੁਤ ਸਹਾਇਕ ਹਨ